ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਰਸੋਈ ਵਿੱਚ ਕਈ ਤਰ੍ਹਾਂ ਦੇ ਬਿਜਲੀ ਦੇ ਉਪਕਰਨ ਹੁੰਦੇ ਹਨ ਸਾਡੇ ਘਰ ਵਿੱਚ ਵੀ ਸਾਡੀ ਰਸੋਈ ਵਿੱਚ ਵੀ ਬਿਜਲੀ ਦੇ ਕਿੰਨੇ ਉਪਕਰਨ ਹਨ ਜਿਵੇਂ ਮਿਕਸਰ ਗ੍ਰੈਂਡਰ ਗੈਸ ਸਿਲੰਡਰ ਓਵਨ ਇਨ੍ਹਾਂ ਸਾਰਿਆਂ ਦੀ ਵਰਤੋਂ ਅਸੀਂ ਲੋਕ ਕਰਦੇ ਹਾਂ ਆਪਣੇ ਕੰਮ ਕਰਨ ਲਈ ਪੁਰਾਣੇ ਦਿਨਾਂ ਨਾਲੋਂ ਇਹ ਤਜ਼ਰਬਾ ਵੱਖਰਾ ਹੈ ਪਹਿਲੇ ਸਮੇਂ ਵਿੱਚ ਇੱਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸਨ ਸਾਡੇ ਸਮੇਂ ਵਿੱਚ ਇੱਦਾਂ ਦੀਆਂ ਚੀਜ਼ਾਂ ਆ ਗਈਆਂ ਹਨ ਮਿਕਸਰ ਨੂੰ ਕੋਈ ਚੀਜ਼ ਮਿਕਸ ਕਰਨ ਲਈ ਵਰਤਿਆ ਜਾਂਦਾ ਹੈ ਗ੍ਰੈਂਡਰ ਨੂੰ ਕੋਈ ਚੀਜ਼